ਬਿਜਲੀ ਸਾਡੀ ਰੋਜ਼ਾਨਾ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜਦੋਂ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਗਰਮੀਆਂ ਵਿੱਚ ਜ਼ਿਆਦਾ ਗਰਮੀ ਕਾਰਨ ਸਾਡੇ ਰੋਜ਼ਾਨਾ ਜੀਵਨ 'ਤੇ ਬਹੁਤ ਰੁਕਾਵਟ ਪੈਂਦੀ ਹੈ ਸਾਡੀ ਸਾਡਾ ਜੋ ਕੰਮ ਸਹੀ ਤਰੀਕੇ ਨਾਲ ਹੋ ਜਾਣਾ ਹੁੰਦਾ ਹੈ ਉਸ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਅਤੇ ਉਹ ਗਰਮੀ ਕਾਰਨ ਬਹੁਤ ਲੇਟ ਨਾਲ ਕੰਮ ਖਤਮ ਕੀਤਾ ਜਾ ਸਕੇ ਕੀਤਾ ਜਾਂਦਾ ਹੈ ਨਵੀਂ ਟੈਕਨੋਲੋਜੀ ਦੇ ਸਾਧਨ ਜਿਵੇਂ ਇਨਵਰਟਰ ਸੋਲਰ ਸਿਸਟਮ ਜਨਰੇਟਰ ਬਿਜਲੀ ਦਾ ਪੱਕਾ ਕਰਨ ਵਾਲੇ ਯੰਤਰ ਉਪਲਬਧ ਹਨ ਇਹ ਯੰਤਰਾਂ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਆਰਾਮਦਾਇਕ ਜ਼ਿੰਦਗੀ ਬਸਰ ਕਰਦੇ ਹਨ ਇਸ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਇਹ ਯੰਤਰ ਸਾਡੇ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਲੋੜਵੰਦ ਹਨ ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਹਰ ਕੰਮ ਬਹੁਤ ਸਰਲ ਤਰੀਕੇ ਨਾਲ ਕਰ ਸਕਦੇ ਹਾਂ